ਉੱਨੀ ਸੌ ਸੱਠ ਦੀ ਗੱਲ ਹੈ ਕਿ ਅਸੀਂ ਛੋਟੇ ਛੋਟੇ ਹੁੰਦੇ ਸੀ ਸਾਡੇ ਮਾਂ ਬਾਪ ਨੇ ਸਾਡੇ ਅਸੀਂ ਚਾਰ ਭੈਣ ਭਰਾ ਸੀ ਚਾਰਾਂ ਭੈਣਾਂ ਭਰਾਵਾਂ ਦੇ ਸਾਡੀਆਂ ਬੁਗਣੀਆਂ ਗੱਲੇ ਜਿਹਨੂੰ ਕਹਿ ਦਿੰਦੇ ਅੱਜ ਕੱਲ੍ਹ ਅਤੇ ਉਹਦੇ ਵਿੱਚ ਹਰ ਮਹੀਨੇ ਦੇ ਮਹੀਨੇ ਉਹਨਾਂ ਨੇ ਸਾਡੇ ਇੱਕ ਇੱਕ ਨਾਮ ਦੇ ਉੱਤੇ ਨਾਮ ਲਿਖਿਆ ਹੁੰਦਾ ਸੀ ਅਤੇ ਉਹਦੇ ਵਿੱਚ ਪੈਸੇ ਪਾ ਦੇਣੇ ਉਦੋਂ ਪੈਸੇ ਕਿਹੜੇ ਚੱਲਦੇ ਸੀ ਮੋਰੀ ਵਾਲਾ ਪੈਸਾ ਘੋੜੇ ਵਾਲਾ ਪੈਸਾ ਅਤੇ ਬਹੁਤ ਪੁਰਾਣੇ ਸਿੱਕੇ ਜਿਵੇਂ ਕਿ ਤਾਂਬੇ ਦੇ ਅਤੇ ਚਾਂਦੀ ਦੇ ਚਾਂਦੀ ਦਾ ਰੁਪਈਆ ਹੁੰਦਾ ਸੀਗਾ ਤਾਂਬੇ ਦੇ ਪੈਸੇ ਪਿੱਤਲ ਦੇ ਪੈਸੇ ਜਿਵੇਂ ਆਨੇ ਚੋਆਨੀਆਂ ਘੜੀਆਂ ਇਹੋ ਜਿਹੇ ਨਾਮ ਮਤਲਬ ਕਿ ਉਦੋਂ ਪੈਸੇ ਹੁੰਦੇ ਸੀਗੇ ਜਿਹੜੇ ਕਿ ਮੈਂ ਅਜੇ ਤੱਕ ਵੀ ਇਹ ਆਪਣੇ ਮਾਂ ਬਾਪ ਦੀ ਘਰ ਦੀ ਨਿਸ਼ਾਨੀ ਸੰਭਾਲੀ ਰੱਖੀ ਹੈ ਜਦੋਂ ਮੇਰੇ ਭੈਣ ਭਰਾ ਸਾਰੇ ਆਪਸ ਵਿੱਚ ਮਾਂ ਬਾਪ ਗੁਜਰ ਗਏ ਅਤੇ ਮਾਂ ਬਾਪ ਗੁਜਰਨ ਤੋਂ ਬਾਅਦ ਅਸੀਂ ਭੈਣਾਂ ਭਰਾਵਾਂ ਨੇ ਸਾਰਾ ਜੋ ਸਮਾਨ ਵੰਡਿਆ ਅਤੇ ਜਿਹੜੇ ਪੈਸੇ ਪਏ ਸੀ ਸਾਡੇ ਜਮ੍ਹਾਂ ਕੀਤੇ ਹੋਏ ਹੁਣ ਤਾਂ ਬੈਂਕਾਂ ਦੇ ਵਿੱਚ ਪੈਸੇ ਜਮ੍ਹਾਂ ਹੋ ਜਾਂਦੇ ਹੈ ਉਦੋਂ ਤਾਂ ਇਸੇ ਤਰ੍ਹਾਂ ਜੋੜੀ ਦੇ ਸੀ ਪੈਸੇ ਗੱਲੇ ਲਾ ਛੱਡਣੇ ਜਾਂ ਮਿੱਕ ਮਿੱਟੀ ਦੀਆਂ ਗੋਲਕਾਂ ਹੁੰਦੀਆਂ ਸੀ ਉਹਦੇ ਵਿੱਚ ਪਾ ਕੇ ਪੈਸੇ ਪਾਈ ਜਾਣੇ ਅਤੇ ਜੋੜ ਲੈਣੇ ਮੈਨੂੰ ਬੜਾ ਸ਼ੌਂਕ ਸੀ ਫਿਰ ਜਦੋਂ ਮੇਰੇ ਭੈਣ ਭਰਾ ਦੋਨੋਂ ਭਰਾ ਮੇਰੇ ਅੱਡ ਹੋ ਗਏ ਤਾਂ ਅਸੀਂ ਚਾਰਾਂ ਭੈਣਾਂ ਭਰਾਵਾਂ ਨੇ ਉਹ ਪੈਸੇ ਅਸੀਂ ਆਖਿਆ ਵੀ ਮੇਰੀ ਭੈਣ ਨੇ ਕਿਹਾ ਵੀ ਇਹ ਆਪਾਂ ਸਾਰੇ ਆਪਾਂ ਵੰਡ ਲਈਏ ਥੋੜ੍ਹੇ ਥੋੜ੍ਹੇ ਅਸੀਂ ਚਾਰ ਢੇਰੀਆਂ ਪਾਈਆਂ ਅਤੇ ਚਾਰਾਂ ਨੇ ਉਹ ਇੱਕ ਇੱਕ ਢੇਰੀ ਸਾਨੂੰ ਆਈ ਅਤੇ ਅਸੀਂ ਉਹ ਪੈਸੇ ਆਪਣੇ ਵੰਡ ਲਏ ਵੰਡਣ ਤੋਂ ਬਾਅਦ ਉਹ ਮੇਰੇ ਕੋਲ ਉਹ ਖਜ਼ਾਨਾ ਮੇਰੇ ਕੋਲ ਅਜੇ ਵੀ ਸੰਭਾਲਿਆ ਪਿਆ ਹੈ ਜਿਨ੍ਹਾਂ ਦੀ ਹੁਣ ਬਹੁਤ ਕੀਮਤ 'ਤੇ ਉਹ ਖਰੀਦੇ ਜਾਂਦੇ ਹਨ ਅਤੇ ਸੋ ਹੁਣ ਤਾਂ ਵੱਡੇ ਦੂਜੇ ਨੋਟ ਚੱਲ ਗਏ ਉ ਉਦੋਂ ਇਹੋ ਹੀ ਪੈਸੇ ਹੁੰਦੇ ਸੀਗੇ ਆਨਾ ਦੁਆਨੀ ਪੈਸਾ ਮੋਰੀ ਵਾਲਾ ਪੈਸਾ ਹੁੰਦਾ ਸੀ ਘੋੜੇ ਵਾਲਾ ਹੁੰਦਾ ਸੀ ਅਤੇ ਉੱਨੀ ਸੌ ਸੰਤਾਲੀ ਵੇਲੇ ਦੇ ਸਿੱਕੇ ਮੇਰੇ ਕੋਲ ਹਜੇ ਵੀ ਪਏ ਨੇ ਜੇ ਅੱਜ ਉਹਨਾਂ ਨੂੰ ਵੇਚ ਕੇ ਤਾਂ ਉਹਨਾਂ ਦੀ ਬਹੁਤ ਕੀਮਤ ਪੈਂਦੀ ਆ ਕਈ ਬਹੁਤ ਅਣਮੁੱਲੀ ਦਾਤ ਆ ਜੋ ਕਿ ਮਾਂ ਬਾਪ ਵੇਲੇ ਦੀ ਸੰਭਾਲੀ ਹੋਈ ਆ ਉਹ ਕਿਸੇ ਵਿਰਲੇ ਵਿਰਲੇ ਕੋਲ ਹੈਗੇ ਨੇ ਬਹੁਤ ਲੋਕਾਂ ਨੇ ਕੋਈ ਚੀਜ਼ਾਂ ਸੰਭਾਲ ਲਈਆਂ ਕੁਛ ਗਵਾ ਲਈਆਂ ਫਿਰ ਮੈਂ ਅਜੇ ਤੱਕ ਵੀ ਥੋੜ੍ਹੇ ਬਹੁਤ ਉਹ ਪੈਸੇ ਰੱਖੀ ਬੈਠੀ ਹਾਂ ਅਤੇ ਅਗਾਂਹ ਮੇਰੇ ਬੱਚੇ ਪੋਤੇ ਪੋਤੀਆਂ ਹੂੰ ਉਹਨਾਂ ਨੂੰ ਜਦੋਂ ਦੱਸਦੀ ਹਾਂ ਅਤੇ ਉਹ ਵੇਖ ਕੇ ਬੜੇ ਹੈਰਾਨ ਹੁੰਦੇ ਆ ਵੀ ਇਹੋ ਜਿਹੇ ਪੈਸੇ ਉਦੋਂ ਚੱਲਦੇ ਸੀਗੇ ਅਤੇ ਅਸੀਂ ਕਿਹਾ ਵੀ ਅਸੀਂ ਤਾਂ ਖਰਚ ਕੇ ਆਉਂਦੇ ਹੁੰਦੇ ਸੀ ਨਿੱਕਾ ਪੈਸਾ ਹੁੰਦਾ ਸੀ ਮੋਰੀ ਵਾਲਾ ਘੋੜੇ ਵਾਲਾ ਉਦੋਂ ਇੱਕ ਪੈਸਾ ਹੀ ਮਿਲਣਾ ਖਰਚਣ ਵਾਸਤੇ ਉਹ ਹੀ ਖਰਚ ਆਉਣਾ ਫੁੱਲੀਆਂ ਪਤਾਸੇ ਲੈ ਆਉਣੇ ਆਪਣਾ ਅਤੇ ਬਸ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੀ ਹੁਣ ਤਾਂ ਬਹੁਤ ਕੁਝ ਚੱਲ ਗਿਆ ਹੁਣ ਤਾਂ ਆਨਲਾਈਨ ਹੀ ਲੋਕ ਖਰੀਦੀ ਜਾਂਦੇ ਸਮਾਨ ਲਿਆਈ ਜਾਂਦੇ ਘਰ ਬੈਠੇ ਮੰਗਵਾਈ ਜਾਂਦੇ ਆ ਅਤੇ ਵਰਤੀ ਜਾਂਦੇ ਆ ਪਰ ਉਹ ਜਮਾਨਾ ਉਦੋਂ ਨਾਲ ਹੀ ਸੀ ਬਹੁਤ ਵਧੀਆ ਸੀ